ਹਾਂ ਮੈਂ ਬਹੁਤ ਸਾਰੀਆਂ ਵੱਡੀਆਂ ਮੂਰਤੀਆਂ ਬਣਾਈਆਂ ਹਨ ਉਨ੍ਹਾਂ ਵਿੱਚੋਂ ਸਭ ਤੋਂ ਵੱਡੀਆਂ ਮੂਰਤੀਆਂ ਜਿਵੇਂ ਕਿ ਸ੍ਰੀ ਹਨੂੰਮਾਨ ਜੀ ਦੀ ਮੂਰਤੀ ਭਗਵਾਨ ਸ਼ਿਵਜੀ ਦੀ ਮੂਰਤੀ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਮੈਂ ਬਣਾਈਆਂ ਹਨ ਮੈਂ ਬਚਪਨ ਵਿੱਚ ਰਾਮਾਇਣ ਦੇਖਦਾ ਹੁੰਦਾ ਸੀ ਅਤੇ ਮਹਾਂਭਾਰਤ ਦਾ ਸੀਰੀਅਲ ਵੇਖਦਾ ਹੁੰਦਾ ਸੀ ਉਹਨਾਂ ਵਿੱਚੋਂ ਮੈਨੂੰ ਦੇਵੀ ਦੇਵਤਿਆਂ ਦੇ ਰੋਲ ਦੇਖ ਕੇ ਸ਼ੌਕ ਪੈਦਾ ਹੋਇਆ ਅਤੇ ਮੈਂ ਉਹਨਾਂ ਦੀਆਂ ਮੂਰਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਮੈਨੂੰ ਮੂਰਤੀਆਂ ਬਣਾਉਣ ਵੇਲੇ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਿ ਸਮਾਨ ਲਿਆਉਣ ਵਾਸਤੇ ਪੈਸੇ ਫਿਰ ਖੁੱਲੀ ਜਗ੍ਹਾ ਦਾ ਪ੍ਰਬੰਧ ਕਰਨਾ ਮੂਰਤੀਆਂ ਦੇ ਅਨੁਕੂਲ ਮਿੱਟੀ ਆਦਿ ਅਤੇ ਉਨ੍ਹਾਂ ਨੂੰ ਬਣਾ ਕੇ ਰੱਖਣ ਵਿੱਚ ਮੈਨੂੰ ਬਹੁਤ ਮੁਸ਼ਕਲਾਂ ਆਈਆਂ ਲੇਕਿਨ ਮੇਰਾ ਤਜ਼ਰਬਾ ਬਹੁਤ ਵਧੀਆ ਰਿਹਾ